ਮਾਨ ਟਰੈਵਲ ਤੋਂ ਗੱਲ ਕਰ ਰਹੇ ਹੋ ਜੀ ਮੈਂ ਨਾ ਹਰਮਨ ਗੱਲ ਕਰ ਰਿਹਾ ਸੋਆੜੇ ਪਿੰਡ ਤੋਂ ਸਾਨੂੰ ਨਾ ਜੀ ਕੈਬ ਚਾਹੀਦੀ ਸੀਗੀ ਸੈਲਫ ਡਰਾਈਵ ਕਾਰ ਚਾਹੀਦੀ ਸੀਗੀ ਸਾਡਾ ਪਲੈਨ ਬਣ ਰਿਹਾ ਜੀ ਘੁੰਮਣ ਜਾਣ ਦਾ ਮਨਾਲੀ ਵੱਲ ਅਤੇ ਸਾਨੂੰ ਸੈਵਨ ਸੀਟਰ ਕਾਰ ਚਾਹੀਦੀ ਹੈ ਜੀ ਅਤੇ ਉਹਦੇ ਵਿੱਚ ਤੁਹਾਡੀਆਂ ਕਿਹੜੀਆਂ ਕਿਹੜੀਆਂ ਕਾ ਕਾਰਾਂ ਜਿਹੜੀਆਂ ਉਪਲਬਧ ਹਨ ਉਹ ਦੱਸ ਦਿਉ ਜੀ ਅਤੇ ਕਿੰਨਾ ਕੁ ਕਿਰਾਇਆ ਪਊਗਾ ਜਾਣ ਦਾ ਉਹ ਦੱਸ ਦਿਉ ਅਤੇ ਕੀ ਕੀ ਡਾਕੂਮੈਂਟੇਸ਼ਨ ਲੱਗੂਗੀ ਜੀ ਉਹਦੇ ਬਾਰੇ ਥੋੜ੍ਹੀ ਜਿਹੀ ਮੈਨੂੰ ਡਿਟੇਲ ਦੱਸ ਦਿਉ ਅਤੇ ਗੱਡੀ ਕਿੰਨੇ ਦਿਨ 'ਚ ਅਵੇਲੇਬਲ ਹੋ ਜਾਊਗੀ ਜੀ ਮਤਲਬ ਮੈਨੂੰ ਅਗਲੇ ਮਹੀਨੇ ਦੀ ਛੇ ਤਰੀਕ ਨੂੰ ਚਾਹੀਦੀ ਹੈ ਜੀ